ਹੈਲੋ ਹੈਲੋ ਹਾਂਜੀ ਸਰ ਪਠਾਨਕੋਟ 'ਚ ਤਾਂ ਬਹੁਤ ਜ਼ਿਆਦਾ ਟਰੈਫਿਕ ਹੋ ਗਿਆ ਹਾਂਜੀ ਸਰ ਹਾਂਜੀ ਸਰ ਸਾਡੇ ਪਠਾਨਕੋਟ 'ਚ ਤਾਂ ਨਾ ਬਹੁਤ ਜ਼ਿਆਦਾ ਹੋ ਗਿਆ ਵਾ ਜਿੱਦਾਂ ਹੁਣ ਉਹੀ ਆ ਨਾ ਸਰ ਇੱਥੇ ਨਾ ਕੋਈ ਰੂਲ ਹੈ ਨਾ ਕੋਈ ਕੁਛ ਹਾਂਜੀ ਹਾਂਜੀ ਸਰ ਘਰ 'ਚ ਤਾਂ ਗੱਡੀਆਂ ਆ ਹਾਂਜੀ ਉਹੀ ਨਾ ਅੱਡ ਵੀ ਕਿਤੇ ਜਾਣਾ ਹੋਏ ਫਿਰ ਗੱਡੀਆਂ 'ਤੇ ਹੀ ਜ਼ੋਰ ਦਿੰਦੇ ਆ ਹਾਂ ਹਾਂਜੀ ਹਾਂਜੀ ਚਲੋ ਠੀਕ ਆ ਓਕੇ ਸਰ